ਮੈਂ ਸੁਬਹ ਪਾਰਕ ਵਿੱਚ ਰਨਿੰਗ ਕਰਨ ਜਾਦੀ ਹਾਂ ਮੇਰੇ ਨਾਲ ਇੱਕ ਕੁੜੀ ਹੋਰ ਹੁੰਦੀ ਆ ਤੇ ਅਸੀਂ ਦੋਵੇਂ ਰਲ ਕੇ ਰਨਿੰਗ ਕਰਦੇ ਹਾਂ ਦੌੜਦੇ ਹਾਂ ਤੇ ਵਿੱਚ ਸ਼ਾਮਿ ਹੁੰਦੇ ਹਾਂ ਤੇ ਅਸੀਂ ਨਹੀਂ ਅਸੀਂ ਇਹ ਫਿੱਟ ਰਹਿਣ ਦੇ ਕਈ ਤੌਰ ਤਰੀਕੇ ਦੱਸਦੇ ਹਾਂ ਤੇ ਆਪਣੇ ਨਾਲ ਦਿਆਂ ਨੂੰ ਵੀ ਫਿਟ ਰਹਿਣ ਦੀ ਕਈ ਤਰੀਕੇ ਸਮਝਾਉਂਦੇ ਹਨ ਤੇ ਆਪਣਾ ਸਰੀਰ ਤੰਦਰੁਸਤ ਰੱਖਣ ਵਿੱਚ ਵੀ ਦੱਸਦੇ ਹਾਂ ਕਿ ਤੁਹਾਨੂੰ ਕਿੱਦਾਂ ਆਪਣਾ ਸਰੀਰ ਤੰਦਰੁਸਤ ਰੱਖਣਾ ਚਾਹੀਦਾ ਹੈ ਤੇ ਆਪਣਾ ਸਰੀਰ ਕਿੱਦਾ ਫਿਟ ਰੱਖਣਾ ਚਾਹੀਦਾ ਕਿੱਦਾ ਖਾਣ ਪੀਣ ਦਾ ਚੀਜ਼ਾਂ ਦਾ ਗਰੇਜ ਰੱਖਣਾ ਚਾਹੀਦਾ ਤੇ ਕਸਰਤ ਕਰਨ ਦੇ ਤੌਰ ਤਰੀਕੇ ਦੱਸੇ ਜਾਂਦੇ ਨੇ ਤੇ ਰਨਿੰਗ ਕਰਨੀ ਚਾਹੀਦੀ ਹੈ ਅਤੇ ਅਨੇਕਾਂ ਚੀਜ਼ਾਂ ਦਾ ਬਚਾਅ ਕਰਨਾ ਚਾਹੀਦਾ ਹੈ ਜੋ ਕਿ ਤੁਹਾਡੇ ਤੁਹਾਡੇ ਮੋਟਾਪੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਮਹਿਸੂਸ ਪੈਦਾ ਕਰਦੇ ਹਨ ਤੇ ਇਸ ਵਿੱਚ ਤੁਹਾਨੂੰ ਤੁਹਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਤੇ ਤੁਸੀਂ ਇਸ ਨਾਂ ਤੋਂ ਬਚ ਸਕਦੇ ਹੋ ਤੇ ਤੁਹਾਨੂੰ ਕਸਰਤ ਹਰ ਰੋਜ਼ ਸੁਬਾਹ ਉਠ ਕੇ ਡੇਲੀ ਕਸਰਤ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਆਪਣੇ ਨਾਲ ਦੀ ਕਿਸੇ ਹੋਰ ਨੂੰ ਵੀ ਦੱਸਣਾ ਚਾਹੀਦਾ ਹੈ ਤੇ ਤੁਸੀਂ ਆਪਣਾ ਮੋਟਾਪੇ ਤੋਂ ਕਿੱਦਾਂ ਬਚਾਅ ਕਰ ਸਕਦੇ ਹੋ ਤੇ ਤੁਹਾਨੂੰ ਕਸਰਤ ਹਮੇਸ਼ਾ ਕਰਨੇ ਹਰ ਰੋਜ ਕਰਨੀ ਚਾਹੀਦੀ ਹੈ ਕਸਰਤ ਕਰਨਾ ਤੁਹਾਡਾ ਸਰੀਰ ਫਿਟ ਰਹਿੰਦਾ ਹੈ ਤੁਸੀਂ ਆਪਣੇ ਨਾਲ ਦੀ ਹੋਰ ਥੋੜਾ ਜਿਹਾ ਹੋਰ ਦਿਨ ਹੋ ਕਈ ਲੋਕਾਂ ਨੂੰ ਵੀ ਦੱਸ ਸਕਦੇ ਤਰੀਕੇ ਤੇਰਾ ਨਹੀਂ ਕਰਨੀ ਚਾਹੀਦੀ ਹੈ ਸੁਬਹਾ ਉੱਠ ਕੇ ਤੇ ਤੁਸੀੰ ਪਾਰਕ ਵਿੱਚ ਕਿਸੇ ਵੀ ਪਾਰਕ ਵਿੱਚ ਜਾਂ ਕਿਸੇ ਵੀ ਖੁੱਲੀ ਜਗਾ ਤੇ ਬਹਿ ਕੇ ਕਸਰਤ ਯੋਗਾ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਸਰੀਰ ਫਿੱਟ ਰਹਿੰਦਾ ਹੈ ਤੇ ਤੁਹਾਨੂੰ ਤੁਹਾਡੇ ਖਾਣ ਪੀਣ ਦੇ ਚੀਜ਼ਾਂ ਵੀ ਘੱਟ ਆ ਜਾਣੀਆ ਤੇ ਉਹਨਾਂ ਨੂੰ ਘਟਾਣ ਦੇ ਕਾਰਨ ਹੀ ਤੁਹਾਡਾ ਸਰੀਰ ਫਿੱਟ ਰਹਿ ਸਕਦਾ ਹੈ ਤੇ ਤੁਸੀਂ ਆਪਣੇ ਨਾਲ ਦਿਆਂ ਨੂੰ ਇਹਚ ਜਾਣਕਾਰੀ ਦੱਸ ਸਕਦੇ ਹੋ ਕਿ ਹਰ ਰੋਜ਼ ਉੱਠ ਕੇ ਯੋਗ ਕਰਨ ਜਾਂਦੀ ਹੈ ਓਕੇ